ਹਾਂਜੀ ਤਰਨ ਤਾਰਨ ਵਿੱਚ ਸਿਹਤ ਸੰਭਾਲ ਲਈ ਕਾਫੀ ਸਹੂਲਤਾਂ ਅਤੇ ਸੇਵਾਵਾਂ ਉਪਲਬਧ ਹਨ ਇੱਥੇ ਸਰਕਾਰੀ ਹਸਪਤਾਲ ਵੀ ਆ ਛੋਟੇ ਛੋਟੇ ਕਲੀਨਿਕ ਵੀ ਹਨ ਅਤੇ ਕਮਿਊਨਿਟੀ ਸੈਂਟਰ ਵੀ ਹਨ ਇਹਨਾਂ ਸਾਰੀਆਂ ਥਾਵਾਂ 'ਤੇ ਮਰੀਜ਼ਾਂ ਦਾ ਅਤੇ ਆਮ ਲੋਕਾਂ ਦੀ ਛੋਟੀ ਤੋਂ ਵੱਡੀ ਬਿਮਾਰੀ ਦਾ ਇਲਾਜ ਪੂਰੀ ਸਹੂਲਤ ਨਾਲ ਕੀਤਾ ਜਾਂਦਾ ਹੈ ਸਰਕਾਰੀ ਹਸਪਤਾਲ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਤਾਂ ਇਹਨਾਂ ਲੋਕਾਂ ਨੂੰ ਦਸ ਰੁਪਏ ਦੀ ਬਣੀ ਇੱਕ ਪਰਚੀ ਜੋ ਕਿ ਇੱਕ ਵਾਰੀ ਬਣਦੀ ਹੈ ਉਸ ਪਰਚੀ 'ਤੇ ਹਰ ਵਾਰ ਡਾਕਟਰੀ ਚੈੱਕਅਪ ਤੋਂ ਬਾਅਦ ਮਰੀਜ਼ਾਂ ਨੂੰ ਫਰੀ ਦਵਾਈ ਦਿੱਤੀ ਜਾਂਦੀ ਹੈ ਆਮ ਲੋਕ ਇਨ੍ਹਾਂ ਹਸਪਤਾਲਾਂ ਕਲੀਨਿਕ ਚਾਹੇ ਕਮਿਊਨਿਟੀ ਸੈਂਟਰ ਹੀ ਕਿਉਂ ਨਾ ਹੋਵੇ ਆਸਾਨੀ ਨਾਲ ਪਹੁੰਚ ਸਕਦੇ ਹਨ ਅਤੇ ਆਸਾਨੀ ਨਾਲ ਆਪਣੀ ਹਰ ਤਕਲੀਫ ਦਾ ਇਲਾਜ ਕਰ ਸਕਦੇ ਹਨ ਕਰਵਾ ਸਕਦੇ ਹਨ ਇਹਨਾਂ ਸੈਂਟਰਾਂ ਵਿੱਚ ਤਾਂ ਹਰ ਟੈਸਟ ਥੋੜ੍ਹੇ ਜਿਹੇ ਪੈਸਿਆਂ ਵਿੱਚ ਹੋ ਜਾਂਦਾ ਹੈ ਇਸ ਲਈ ਇਹ ਸਿਹਤ ਸੰਭਾਲ ਸੈਂਟਰ ਆਮ ਲੋਕਾਂ ਲਈ ਬਹੁਤ ਹੀ ਕਿਫਾਇਤੀ ਸਾਬਤ ਹੋਏ ਹਨ ਇੱਥੋਂ ਤੱਕ ਕਿ ਕੋਵਿਡ ਵਰਗੀ ਮਹਾਂਮਾਰੀ ਦੇ ਦੌਰਾਨ ਇਨ੍ਹਾਂ ਹਸਪਤਾਲਾਂ ਵਿੱਚ ਬਹੁਤ ਹੀ ਧਿਆਨ ਨਾਲ ਕੰਮ ਕੀਤਾ ਗਿਆ ਸੀ ਸਾਰੇ ਹਸਪਤਾਲ ਦੇ ਸਟਾਫਾਂ ਨੇ ਰਲ ਮਿਲ ਕੇ ਕੋਵਿਡ ਦੀ ਬਿਮਾਰੀ ਵਿੱਚ ਪੀੜਿਤ ਲੋਕਾਂ ਦੀ ਬਹੁਤ ਸੇਵਾ ਕੀਤੀ ਉਹਨਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਇਸ ਕਰਕੇ ਇਨ੍ਹਾਂ ਹਸਪਤਾਲਾਂ ਦੁਆਰਾ ਦਿੱਤੀਆਂ ਸੇਵਾਵਾਂ ਅਤੇ ਸਹੂਲਤਾਂ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਰਹੀਆਂ ਅਤੇ ਕੋਵਿਡ ਵਰਗੀ ਭਿਆਨਕ ਬਿਮਾਰੀ ਤੋਂ ਵੀ ਉਹ ਆਸਾਨੀ ਨਾਲ ਬਚ ਸਕੇ